ਪੰਜਾਬ ਦੇ ਵਿੱਚ ਨਸ਼ੇ ਦੀ ਆਦਤ ਨੇ ਸਾਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਨਸ਼ਾ ਇੱਕ ਬਹੁਤ ਹੀ ਬੁਰੀ ਲਾਹਨਤ ਹੈ ਜਿਸ ਨੇ ਸਾਡੇ ਨੌਜਵਾਨ ਬੱਚਿਆਂ ਦੇ ਸਾਡੀ ਸਾਰੀ ਪੀੜ੍ਹੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ ਨਸ਼ਾ ਪਹਿਲਾਂ ਪੰਜਾਬ ਵਿੱਚ ਪਹਿਲਾਂ ਵੀ ਹੁੰਦਾ ਸੀ ਪਰ ਹੁਣ ਵਾਲਾ ਜਿਹੜਾ ਨਸ਼ਾ ਪੰਜਾਬ ਵਿੱਚ ਆ ਰਿਹਾ ਹੈ ਉਹ ਇੱਕ ਬਹੁਤ ਹੀ ਗੰਭੀਰ ਨਸ਼ਾ ਹੈ ਜੋ ਕਿ ਬੱਚੇ ਤੋਂ ਲੈ ਕੇ ਨੌਜਵਾਨ ਪੀੜ੍ਹੀ ਸਭ ਹੀ ਉਸਦੇ ਵਿੱਚ ਬਰਬਾਦ ਹੋ ਰਹੇ ਹਨ ਘਰਾਂ ਦੇ ਘਰ ਖਰਾਬ ਕਰ ਰਿਹਾ ਹੈ ਨਸ਼ਾ ਪੰਜਾਬ ਦੇ ਵਿੱਚ ਕੀ ਇੱਕ ਮੁੱਖ ਮੰਤਰੀ ਇੰਨਾ ਵੀ ਨਹੀਂ ਕਰ ਸਕਦੇ ਕਿ ਸਾਡੇ ਮੰਤਰੀ ਕਿ ਇਸ ਨਸ਼ੇ ਨੂੰ ਖਤਮ ਕਰ ਸਕਣ ਤਾਂ ਕਿ ਬੱਚੇ ਬਚ ਸਕਣ ਸਾਡੀ ਨੌਜਵਾਨ ਪੀੜ੍ਹੀ ਬਚ ਸਕੇ ਕਿੱਥੇ ਬੱਚੇ ਸਾਡੇ ਪਹਿਲਾਂ ਪਹਿਲਵਾਨ ਹੁੰਦੇ ਸੀ ਖਿਡਾਰੀ ਹੁੰਦੇ ਸੀ ਇੰਨੀ ਅੱਛੀ ਨੌਜਵਾਨ ਪੀੜ੍ਹੀ ਸੀ ਜਿਹਨਾਂ ਨੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅੱਜ ਦੇ ਸਾਡੇ ਬੱਚੇ ਨਸ਼ੇ ਦੇ ਵਿੱਚ ਖਰਾਬ ਹੋ ਰਹੇ ਆ ਇੰਨੇ ਸੋਹਣੇ ਅਤੇ ਇੰਨੇ ਨੌਜਵਾਨ ਬੱਚੇ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਹੋਣ ਦੇ ਬਾਵਜੂਦ ਸਾਡੇ ਘਰ ਖਰਾਬ ਹੋ ਰਹੇ ਆ ਸਾਡੇ ਨਸ਼ੇ ਨੇ ਸਾਡੇ ਬੱਚੇ ਸਾਡੇ ਤੋਂ ਖੋਹ ਲਏ ਗਏ ਨੇ ਸਾਡੇ ਘਰ ਖਾਲੀ ਹੋ ਗਏ ਹਨ ਪੰਜਾਬ ਦੇ ਵਿੱਚ ਇਸ ਚੀਜ਼ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਹੈ ਇੱਕ ਬਹੁਤ ਹੀ ਕਾਲੀ ਅਤੇ ਗੰਦੀ ਕਲੰਕ ਹੈ ਪੰਜਾਬ ਦੇ ਉੱਤੇ ਬੱਚੇ ਬਾਹਰ ਜਾ ਰਹੇ ਹਨ ਪੰਜਾਬ ਨੂੰ ਛੱਡ ਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਨਸ਼ੇ ਤੋਂ ਬਚਾਉਣ ਦੇ ਲਈ ਪਰ ਨਸ਼ੇ ਨਸ਼ੇ ਬਾਹਰ ਵੀ ਬੱਚੇ ਕਰ ਰਹੇ ਹਨ ਜਾ ਕੇ ਪਰ ਜਿਹਨਾਂ ਨੂੰ ਇਹ ਆਦਤ ਪੈ ਚੁੱਕੀ ਹੈ ਪੈਸਾ ਬਰਬਾਦ ਹੋ ਚੁੱਕਿਆ ਹੈ ਘਰ ਦੇ ਘਰ ਖਰਾਬ ਹੋ ਚੁੱਕੇ ਹਨ ਇਸ ਚੀਜ਼ ਨੇ ਸਾਨੂੰ ਬਹੁਤ ਜ਼ਿਆਦਾ ਹੈਰਾਨ ਕੀਤਾ ਹੈ